ਮੈਂ ਫਲਿਪਕਾਰਟ ਤੋਂ ਆਪਣਾ ਦੂਸਰਾ ਪ੍ਰੋਡਕਟ ਇੱਕ ਮੰਗਵਾਇਆ ਸੀ ਪਹਿਲਾਂ ਪ੍ਰੋਡਕਟ ਨੇ ਬਹੁਤ ਅੱਛਾ ਦਿੱਤਾ ਬਹੁਤ ਅੱਛਾ ਵਧੀਆ ਨਿਕਲਿਆ ਔਰ ਦੂਸਰੇ ਪਰਸ ਜਿਹੜਾ ਪ੍ਰੋਡਕਟ ਉਹਨੇ ਮੈਨੂੰ ਬਹੁਤ ਜ਼ਿਆਦਾ ਮਾਯੂਸ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਤਾਂ ਆਉਣ ਦੇ ਵਿੱਚ ਹੀ ਬਹੁਤ ਲੇਟ ਹੋਇਆ ਉਸ ਤੋਂ ਬਾਅਦ ਜਿਹੜਾ ਮੇਰਾ ਕੈਮਰਾ ਮੈਂ ਜਿਹੜਾ ਆਰਡਰ ਕੀਤਾ ਸੀ ਸੈਕਿੰਡ ਪ੍ਰੋਡਕਟ ਉਹ ਪ੍ਰੋਡਕਟ ਦੀ ਜਿਹੜੀ ਪੈਕਿੰਗ ਸੀਗੀ ਉਹ ਪੈਕਿੰਗ ਹੀ ਬਹੁਤ ਜ਼ਿਆਦਾ ਮਾੜੀ ਸੀ ਔਰ ਅੱਧੇ ਤੋਂ ਜ਼ਿਆਦਾ ਜਿਹੜੀ ਸੀ ਉਹ ਖੁੱਲ੍ਹੀ ਹੋਈ ਸੀ ਪਰ ਚੱਲੋ ਮੈਂ ਫਿਰ ਵੀ ਉਹ ਪ੍ਰੋਡਕਟ ਰਿਸੀਵ ਕਰਕੇ ਉਹ ਪ੍ਰੋਡਕਟ ਨੂੰ ਜਦੋਂ ਓਪਨ ਕੀਤਾ ਤਾਂ ਉਸ ਪ੍ਰੋਡਕਟ ਦੇ ਉੱਤੇ ਸਕਰੈਚਿਸ ਪਏ ਹੋਏ ਸੀ ਜਿੱਦਾਂ ਕਿ ਪ੍ਰੋਡਕਟ ਕੋਈ ਸੈਕਿੰਡ ਹੈਂਡ ਹੋਵੇ ਉਸ ਤੋਂ ਬਾਅਦ ਉਹ ਪ੍ਰੋਡਕਟ ਜਦੋਂ ਮੈਂ ਯੂਜ ਕਰਨ ਲੱਗਿਆ ਫਿਰ ਤਾਂ ਉਹ ਪ੍ਰੋਡਕਟ ਜਿਹੜਾ ਸੀ ਉਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਨਾ ਹੀ ਉਹਦੀ ਬੈਟਰੀ ਜਿਹੜੀ ਆ ਉਹ ਕਿਉਂਕਿ ਇਹ ਨਿਕੋਨ ਕੰਪਨੀ ਦਾ ਕੈਮਰਾ ਤਾਂ ਬਿਲਕੁਲ ਹੀ ਬਿਲਕੁਲ ਪੈਕਡ ਆਉਂਦਾ ਬਟ ਇਹਦੀ ਆ ਕਾਫ਼ੀ ਪੈਕਿੰਗ ਜਿਹੜੀਆਂ ਸੀ ਉਹ ਓਪਨ ਹੋਈਆਂ ਹੋਈਆਂ ਸੀ ਅਤੇ ਇਹਦੀ ਜਿਹੜੀ ਬੈਟਰੀ ਸੀ ਉਹ ਵੀ ਉਹਦੀ ਵੀ ਸੀਲ ਜਿਹੜੀ ਉਹ ਨਿਕਲੀ ਹੋਈ ਸੀਗੀ ਅਤੇ ਉਹ ਵਰਕਿੰਗ ਕੰਡੀਸ਼ਨ ਦੇ ਵਿੱਚ ਸੀਗਾ ਜਿੱਦਾਂ ਆਨ ਆਫ ਕਰਕੇ ਪਹਿਲਾਂ ਹੀ ਕਿਸੇ ਨੇ ਵਿੱਚ ਰੱਖਿਆ ਹੋਵੇ ਅਤੇ ਇਹ ਜਿਹੜਾ ਐਕਸਪੀਰੀਅੰਸ ਸੀ ਮੇਰਾ ਤਾਂ ਮੈਂ ਜਦੋਂ ਉਹਨੂੰ ਵਾਪਿਸ ਕਰਨ ਵਾਸਤੇ ਤ ਭੇਜਿਆ ਤਾਂ ਉਹ ਵਾਪਿਸ ਕਰਨ ਵਾਲੇ ਵੀ ਕਹਿੰਦੇ ਕਿ ਇਹ ਟੁੱਟਾਂ ਨਹੀਂ ਆ ਹਜੇ ਕੋਈ ਇਹਦੇ 'ਚ ਕਰੈਕ ਨਹੀਂ ਆ ਅਤੇ ਅਸੀਂ ਇਹਨੂੰ ਵਾਪਿਸ ਨਹੀਂ ਲੈ ਸਕਦੇ ਸੋ ਜਿਹੜਾ ਮੇਰਾ ਐਕਸਪੀਰੀਅੰਸ ਆ ਸੈਕਿੰਡ ਪ੍ਰੋਡਕਟ ਦਾ ਬਹੁਤ ਹੀ ਮਾੜਾ ਅਤੇ ਬਹੁਤ ਹੀ ਖਰਾਬ ਰਿਹਾ ਤੋ ਮੈਂ ਇਹ ਹੀ ਕਹਿਣਾ ਚ ਕਿ ਇਹ ਨਿ ਕੈਮਰਾ ਆ ਇਹ ਔਨਲਾਈਨ ਲਿਆ ਜਿਹੜਾ ਇਹਦਾ ਇਲੈਕਟਰੋਨਿਕਸ ਪ੍ਰੋਡਕਟ ਨੂੰ ਧਿਆਨ ਨਾਲ ਲੈ ਕੇ ਹੀ ਖਰੀਦਿਆ ਜਾਵੇ